ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਤੇਜਪਾਲਜੀਤ ਸਿੰਘ ਆ ਅਤੇ ਜਿੱਦਾਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਸਾਡੇ ਅੱਜ ਅੱਜ ਦੇ ਜਮਾਨੇ ਵਿੱਚ ਕਈ ਤਕਨੀਕੀ ਨਵੇਂ ਨਵੇਂ ਰੁਝਾਨ ਆ ਚੁੱਕੇ ਹਨ ਜਿਨ੍ਹਾਂ ਤੋਂ ਲੋਕ ਬਹੁਤ ਉਤਸ਼ਾਏ ਹਨ ਕਈ ਨਵੇਂ ਨਵੇਂ ਉਤਸ਼ਾਹਿਤ ਤਕਨੀਕੀ ਤਕਨੀਕਾਂ ਆ ਚੁੱਕੀਆਂ ਹਨ ਕਈ ਕਈ ਨਵੇਂ ਡਿਵਾਈਸਾਂ ਆ ਚੁੱਕੀਆਂ ਹਨ ਜੋ ਕਿ ਸਾਡੇ ਰੋਜ਼ਾਨਾ ਜੀਵਨ ਵਿੱਚ ਬਹੁਤ ਮਹੱਤਵਪੂਰਨ ਯੋਗਦਾਨ ਪਾਉਂਦੀਆਂ ਹਨ ਇਨਾ ਇਹਨਾਂ ਇਹਨਾਂ ਵਿੱਚੋਂ ਹੀ ਇੱਕ ਇੱਕ ਤਕਨੀਕੀ ਰੁਝਾਨ ਹੈ ਜਿਸਨੂੰ ਅੱਜ ਕੱਲ੍ਹ ਮੋਬਾਈਲ ਫੋਨ ਕਹਿੰਦੇ ਹਨ ਜਿਹੜਾ ਕਿ ਸਾਡੇ ਅੱਜ ਦੇ ਰੋਜ਼ਾਨਾ ਜੀਵਨ ਵਿੱਚ ਬਹੁਤ ਮਹੱਤਵਪੂਰਨ ਭੂਮਿਕਾ ਨਿਭਾ ਰਿਹਾ ਹੈ ਇਹ ਬਹੁਤ ਹੀ ਇੱਕ ਵਧੀਆ ਚੀਜ਼ ਹੈ ਜਿਸ ਤੋਂ ਲੋਕ ਕਈ ਕੰਮ ਲੈਂਦੇ ਹਨ ਜਿਵੇਂ ਕਿ ਨਵੇਂ ਨਵੇਂ ਖਾਣੇ ਬਣਾਉਣ ਦੇ ਤਕਨੀਕਾਂ ਇੱਥੋਂ ਸਿੱਖਦੇ ਹਨ ਨਵੇਂ ਨਵੇਂ ਫੋਟੋਆਂ ਇੱਥੋਂ ਸਿੱਖਦੇ ਹਨ ਆਪਣੇ ਆਪਣੇ ਕਈ ਕਾਗਜ਼ ਇੱਥੇ ਸਾਂਭ ਕੇ ਰੱਖ ਸਕਦੇ ਹਨ ਆਪਣੇ ਹਰ ਤਰ੍ਹਾਂ ਦੇ ਦੋਸਤ ਨਾਲ ਕਿਸੇ ਵੀ ਤਰ੍ਹਾਂ ਗੱਲ ਕਰ ਸਕਦੇ ਹਨ ਇਸ ਤਰ੍ਹਾਂ ਦੇ ਹੋਰ ਵੀ ਕਈ ਕੰਮ ਆਪਾਂ ਸਾਡੇ ਮੋਬਾਈਲ ਫੋਨ ਤੋਂ ਲੈ ਸਕਦੇ ਹਨ ਇਸ ਤੋਂ ਇਲਾਵਾ ਹੋਰ ਵੀ ਕਈ ਤਕਨੀਕੀ ਰੁਝਾਨ ਹਨ ਜਿਵੇਂ ਕਿ ਲੈਪਟੋਪ ਜਿਵੇਂ ਕਿ ਏ ਸੀ ਐਹੋ ਜਿਹੇ ਤਕਨੀਕੀ ਰੁਝਾਨ ਹਨ ਜੋ ਕਿ ਸਾਡੇ ਰੋਜ਼ਾਨਾ ਜੀਵਨ ਵਿੱਚ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ ਇਸ ਤਰ੍ਹਾਂ ਦੇ ਹੋਰ ਵੀ ਕਈ ਹਨ ਜੋ ਕਿ ਸਾਡੇ ਰੋਜ਼ਾਨਾ ਜੀਵਨ ਵਿੱਚ ਹੁੰਦੇ ਹਨ ਅਤੇ ਲੋਕ ਇਹਨਾਂ ਤੋਂ ਕੰਮ ਲੈਂਦੇ ਹਨ ਜਿਹੜੇ ਕਿ ਸਾਡੇ ਆਉਣ ਵਾਲੀ ਪੀੜ੍ਹੀ ਲਈ ਬਹੁਤ ਹੀ ਜ਼ਰੂਰੀ ਹੈ ਧੰਨਵਾਦ